ਰੂਪਨਗਰ ਜ਼ਿਲ੍ਹੇ ਵਿੱਚ ਜੇਕਰ ਆਵਾਜਾਈ ਦਾ ਮੁੱਖ ਸਾਧਨ ਦੇਖਿਆ ਜਾਵੇ ਤਾਂ ਉਹ ਬੱਸਾਂ ਹਨ ਆਮ ਆਦਮੀ ਦੇ ਤੌਰ 'ਤੇ ਵੀ ਇਹ ਬਹੁਤ ਜਾਇਜ਼ ਸਾਧਨ ਹੈ ਪਰੰਤੂ ਜੇਕਰ ਇਸ ਦੇ ਖ਼ਿਲਾਫ਼ ਚੁਣੌਤੀਆਂ ਨੂੰ ਦੇਖਿਆ ਜਾਵੇ ਤਾਂ ਸਭ ਤੋਂ ਵੱਧ ਇਹ ਹਨ ਕਿ ਪੰਜਾਬ ਸਰਕਾਰ ਨੇ ਸਰਕਾਰੀ ਬੱਸਾਂ ਵਿੱਚ ਔਰਤਾਂ ਦਾ ਕਿਰਾਇਆ ਮੁਫ਼ਤ ਕਰ ਦਿੱਤਾ ਹੈ ਜਿਸ ਕਾਰਨ ਬੱਸ ਵਿੱਚ ਕਾਫ਼ੀ ਭੀੜ ਭੜੱਕਾ ਔਰਤਾਂ ਦੇ ਕਾਰਨ ਹੋ ਜਾਂਦਾ ਹੈ ਅਤੇ ਖੈਬੜਬਾਜ਼ੀ ਵੀ ਦੇਖਣ ਨੂੰ ਮਿਲਦੀ ਹੈ ਦੂਜੇ ਪਾਸੇ ਜੇਕਰ ਪ੍ਰਾਈਵੇਟ ਬੱਸਾਂ ਦੀ ਗੱਲ ਹੋਵੇ ਤਾਂ ਉਹ ਉਦੋਂ ਤੱਕ ਬੱਸ ਨਹੀਂ ਤੋਰਦੇ ਜਦ ਤੱਕ ਬੱਸ ਪੂਰੇ ਤਰੀਕੇ ਨਾਲ਼ ਭਰ ਨਹੀਂ ਜਾਂਦੀ